ਜੇਕਰ ਅਸੀਂ ਵਹਿਮ ਭਰਮ ਦੀ ਗੱਲ ਕਰੀਏ ਤਾਂ ਅੱਜ ਚਾਹੇ ਭਾਰਤ ਜਿੰਨਾ ਨ ਭਾਰਤ ਪੰਜਾਬ ਜਿੰਨਾ ਮਰਜ਼ੀ ਪੜ੍ਹੇ ਲਿਖੇ ਲੋਕ ਰਹਿੰਦੇ ਹੋਣ ਪਰ ਫਿਰ ਵੀ ਕੁਛ ਲੋਕ ਜਿਹੜੇ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਵਹਿਮ ਭਮ ਭਰਮ ਜਿਹੜੇ ਆ ਉਹ ਕੀਤੇ ਜਾਂਦੇ ਨੇ ਜਿਵੇਂ ਕਿ ਮੰਗਲਵਾਰ ਵੀਰਵਾਰ ਸ਼ਨੀਵਾਰ ਸਿਰ ਨਹੀਂ ਧੋਣਾ ਨੇਲ ਨਹੀਂ ਕੱਟਣੇ ਅਤੇ ਜੇਕਰ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਅਤੇ ਜੇ ਪਹਿਲਾਂ ਹੀ ਬਿੱਲੀ ਰਸਤਾ ਕੱਟ ਜੇ ਤਾਂ ਲੋਕ ਸਮਝਦੇ ਸਾਡਾ ਕੰਮ ਨਹੀਂ ਬਣੇਗਾ ਅਤੇ ਉਹ ਰੁਕ ਜਾਂਦੇ ਨੇ ਜੇ ਕਿਸੇ ਨੇ ਛਿੱਕ ਮਾਰ ਦਿੱਤੀ ਹੈ ਤਾਂ ਲੋਕ ਬਾਹਰ ਜਾਣ ਤੋਂ ਸੌ ਵਾਰੀ ਸੋਚਦੇ ਨੇ ਕਿ ਠਹਿਰ ਕੇ ਜਾਈਏ ਥੋੜ੍ਹਾ ਕਿ ਸਾਡਾ ਕੰਮ ਨਹੀਂ ਬਣੇਗਾ ਅਤੇ ਕਈ ਵਾਰੀ ਜੇਕਰ ਪਿੱਛੇ ਮੁੜਨਾ ਘਰੋਂ ਨਿਕਲ ਕੇ ਅਤੇ ਪਿੱਛੇ ਮੁੜਨਾ ਪੈ ਜਾਵੇ ਤਾਂ ਫਿਰ ਲੋਕ ਘਰ ਆ ਕੇ ਚੀਨੀ ਖਾ ਕੇ ਜਾਂਦੇ ਆ ਜਾਂ ਪਾਣੀ ਪੀ ਕੇ ਜਾਂਦੇ ਆ ਕਿ ਜਿਸ ਨਾਲ ਉਹਨਾਂ ਨੂੰ ਲੱਗਦਾ ਕਿ ਸਾਡਾ ਕੰਮ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਬਣੇਗਾ ਜਿਵੇਂ ਚੀਨੀ ਖਾਣਗੇ ਪਾਣੀ ਪੀਣਗੇ ਅਤੇ ਉਹਨਾਂ ਦਾ ਕੰਮ ਬਣ ਜਾਵੇਗਾ ਇਸ ਤਰੀਕੇ ਦੇ ਬਹੁਤ ਸਾਰੇ ਵਹਿਮ ਭਰਮ ਜਿਹੜੇ ਉਹ ਕੀਤੇ ਜਾਂਦੇ ਨੇ